ਮੈਂ ਆਪਣੇ ਦੋਸਤ ਦੇ ਜਨਮਦਿਨ ਦੀ ਪਾਰਟੀ ਦਾ ਪ੍ਰਬੰਧ ਕੀਤਾ ਜਿਸ ਵਿੱਚ ਮੈਂ ਵੱਡੀ ਮਾਤਰਾ ਵਿੱਚ ਭੋਜਨ ਔਰਡਰ ਕੀਤਾ ਮੇਰੇ ਦੋਸਤ ਦਾ ਜਨਮ ਦਿਨ ਬ ਬਾਈ ਨਵੰਬਰ ਨੂੰ ਹੁੰਦਾ ਹੈ ਜਿਸ ਵਿੱਚ ਮੈਂ ਵੱਡੀ ਮਾਤਰਾ ਵਿੱਚ ਔਨਲਾਈਨ ਭੋਜਨ ਔਰਡਰ ਕੀਤਾ ਜਿਸ ਵਿੱਚ ਮੈਂ ਕਈ ਪ੍ਰਕਾਰ ਦੇ ਸਨੈਕਸ ਦਾ ਵੀ ਔਰਡਰ ਕੀਤਾ ਜਿਵੇਂ ਕਿ ਮੰਚੂਰੀਅਨ ਬਰਗਰ ਨਿਊਡਲ ਅਤੇ ਹੋਰ ਖਾਣ ਵਾਲੀਆਂ ਵਸਤੂਆਂ ਸਾਰੀਆਂ ਹੀ ਵਸਤੂਆਂ ਖਾਣ ਵਿੱਚ ਬਹੁਤ ਹੀ ਗਰਮ ਅਤੇ ਤਾਜ਼ੀਆਂ ਲੱਗ ਰਹੀਆਂ ਸਨ ਮੈਨੇ ਖਾਣ ਦੇ ਨਾਲ ਨਾਲ ਸਨੈ ਰੋਟੀ ਦਾ ਵੀ ਔਰਡਰ ਕੀਤਾ ਜਿਸ ਵਿੱਚ ਦਾਲ ਸਬਜ਼ੀ ਅਤੇ ਨਾਨ ਵੀ ਸਨ ਸਾਰੀਆਂ ਹੀ ਸਬਜ਼ੀਆਂ ਗਰਮ ਅਤੇ ਤਾਜ਼ੀਆਂ ਲੱਗ ਰਹੀਆਂ ਸਨ ਮੇਰੇ ਦੋਸਤ ਨੂੰ ਗੁਲਾਬ ਜਾਮੁਨ ਬਹੁਤ ਪਸੰਦ ਹੈ ਇਸ ਲਈ ਮੈਂ ਉ ਆਪਣੇ ਦੋਸਤਾਂ ਦੇ ਲਈ ਗੁਲਾਬ ਜਾਮੁਨ ਦਾ ਵੀ ਔਰਡਰ ਕੀਤਾ ਅਖੀਰ ਦੇ ਵਿੱਚ ਮੈਂ ਆਪਣੇ ਦੋਸਤਾਂ ਲਈ ਇੱਕ ਕੇਕ ਦਾ ਪ੍ਰਬੰਧ ਕੀਤਾ ਕੇਕ ਹੀ ਬਹੁਤ ਹੀ ਤਾਜ਼ਾ ਸੀ ਅਤੇ ਖਾਣ ਵਿੱਚ ਬਹੁਤ ਹੀ ਸਵਾਦਿਸ਼ਟ ਸੀ ਸਾਰਾ ਹੀ ਖਾਣ ਪੀਣ ਦਾ ਸਮਾਨ ਬਹੁਤ ਹੀ ਸਵਾਦਿਸ਼ਟ ਸੀ ਸਾਰਾ ਸਮਾਨ ਔਨਲਾਈਨ ਔਰਡਰ ਕੀਤਾ ਸੀ ਜੋ ਕਿ ਸਮੇਂ 'ਤੇ ਹੀ ਡਿਲੀਵਰ ਕਰ ਦਿੱਤਾ ਗਿਆ ਸੀ ਵੱਡੀ ਮਾਤਰਾ ਵਿੱਚ ਔਰਡਰ ਕਰਨ 'ਤੇ ਮੈਨੂੰ ਭਾਰੀ ਵੱਡੀ ਮਾਤਰਾ ਵਿੱਚ ਛੂਟ ਵੀ ਮਿਲੀ ਸੀ